ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਭਾਅ ਜੀ ਸਨੇਕ ਡੇਰੀ ਤੋਂ ਬੋਲਦੇ ਓ ਹਾਂਜੀ ਹਾਂਜੀ ਹਾਂਜੀ ਤੇ ਅਸੀਂ ਇਹ ਪੁੱਛਣਾ ਸੀ ਵੀ ਆਪਣੇ ਕੀ ਕੀ ਐਟਮਾਂ ਹੁੰਦੀਆਂ ਡੇਰੀ ਤੇ ਹਾਂਜੀ ਜੀ ਹਾਂਜੀ ਜੀ ਹਾਂਜੀ ਜੀ ਅੱਛਿਆ ਜੀ ਤੇ ਦੁੱਧ ਕੀ ਰੇਟ ਦਿੰਦੇ ਓ ਭਾਅ ਜੀ ਹਾਂਜੀ ਹਾਂਜੀ ਜੀ ਹਾਂਜੀ ਜੀ ਠੀਕ ਐ ਜੀ ਤੇ ਪਜਵੰਜਾ ਆਲੇ ਤੇ ਮਲਾਈ ਆਉਂਦੀ ਹੋਨੀ ਠੀਕ ਐ ਜੀ ਹਾਂਜੀ ਜੀ ਹਾਂਜੀ ਤੇ ਇਹ ਗਾਈਆਂ ਦਾ ਤਾਂ ਨੀ ਪਾਉਂਦੇ ਵਿੱਚ ਫੇਰ ਤੁਸੀਂ ਹਾਂਜੀ ਹਾਂਜੀ ਜੀ ਹਾਂਜੀ ਜੀ ਵੈਸੇ ਹਾਂਜੀ ਵੈਸੇ ਬੱਕਰੀ ਦਾ ਵੀ ਦੁੱਧ ਹਾਂਜੀ ਹਾਂਜੀ ਉਹ ਤਾਂ ਜਦੋਂ ਬਿਮਾਰ ਸਮਾਰ ਹੋਜੇ ਉਦੋਂ ਲੈਣਾ ਪੈਂਦਾ ਮਾੜਾ ਮੋਟਾ ਜਦੋਂ ਸੈੱਲ ਸੂੱਲ ਘੱਟ ਜਾਂਦੇ ਐ ਹਾਂਜੀ ਹਾਂਜੀ ਜੀ ਤੇ ਹੋਰ ਘਿਓ ਕੀ ਰੇਟ ਦਿਨੇ ਓ

ਠੀਕ ਐ ਜੀ ਹਾਂਜੀ ਠੀਕ ਐ ਜੀ ਵਧੀਆ ਨਿਕਾਰਸ ਹੁੰਦੀ ਐ ਦਹੀਂ ਹੈਂ ਹਾਂਜੀ ਜੀ ਹਾਂਜੀ ਮੈਂ ਕਈ ਵਾਰੀ ਵੇਖਿਆ ਨਾ ਡੇਰੀਆਂ ਦੇ ਉੱਤੇ ਛਾਪੇ ਪੈ ਜਾਂਦੇ ਆ ਘਿਓ ਦੇ ਵਿੱਚ ਵੀ ਆਲੂ ਪਾ ਦਿੰਦੇ ਆ ਮਿਕਸ ਕਰ ਦਿੰਦੇ ਆ ਹਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਬੱਚਿਆਂ ਆਲੇ ਵੀ ਰੱਖ ਬੱਚਿਆਂ ਆਲੇ ਵੀ ਰੱਖਦੇ ਹੋਉਗੇ ਬੱਚਿਆਂ ਆਲੀਆਂ ਐਟਮਾਂ ਵੀ ਰੱਖਦੇ ਹੋਉਗੇ ਹਾਂਜੀ ਜੀ ਹਾਂਜੀ ਜੀ ਠੀਕ ਐ ਨਹੀਂ ਵਧੀਆ ਕੰਮ ਚੱਲਿਆ ਆਪਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਦੂਜਾ ਹੋਰ

ਹਾਂਜੀ ਹਾਂਜੀ ਹਾਂਜੀ ਵੀ ਚੁਵਾਵਾਂ ਦਾ ਤਾਂ ਆ ਕਈ ਵਾਰੀ ਗਾਈਆਂ ਦੇ ਨਾਲ ਈ ਬੈਠੇ ਹੁੰਦੇ ਐ ਇਹ ਮਿਕਸ ਕਰ ਦਿੰਦੇ ਆ ਡੇਰੀਆਂ ਆਲੇ ਹਾਂਜੀ ਹਾਂਜੀ ਜੇ ਚੁਆਵਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਐ ਐਏ ਆ ਨਾ ਭਾਅ ਜੀ ਚੰਗਾ ਦੁੱਧ ਵੇਚੋਗੇ ਤਾ ਗਾਹਾਂ ਚੰਗੀਆਂ ਗੱਲਾਂ ਹੁੰਦੀਆਂ ਜੇ ਮਾੜਾ ਵੇਚੋਗੇ ਤੇ ਚਲੋ ਭਾਜੀ ਆਪਾਂ ਬਹਿਨੇ ਆਂ ਫਿਰ ਕਿਸੀ ਦਿਨ ਅਸੀਂ ਆਉਨੇ ਆ ਘਰੇ ਹੈਂ ਠੀਕ ਐ ਜੀ ਠੀਕ ਐ ਜੀ